ਸਭ ਤੋਂ ਪਹਿਲਾਂ ਡਰਾਈਵਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨੀ ਰਾਤ ਵੇਲੇ ਮੈਨੂੰ ਮੇਰੇ ਘਰ ਸੁਰੱਖਿਅਤ ਢੰਗ ਨਾਲ ਪਹੁੰਚਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਅੱਗੇ ਤੋਂ ਵੀ ਮੈਂ ਕਿਤੇ ਜਾਣਾ ਹੋਵੇਗਾ ਮੈਂ ਤੁਹਾਨੂੰ ਹੀ ਸੰਪਰਕ ਕਰਾਂਗੀ